ਵੀਰ ਆਪਾਂ ਨੇ ਵੀਹ ਮਿੰਟ ਤੱਕ ਮੋਹਾਲੀ ਪਹੁੰਚਣਾ ਜਰੂਰੀ ਮੀਟਿੰਗ ਹੈ ਅਤੇ ਉਰੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਕੋਈ ਹੋਰ ਰਸਤਾ ਹੈਗਾ ਹੈ ਤਾਂ ਮੇਰਾ ਵੀਰ ਬਣ ਕੇ ਦੱਸ ਛੇਤੀ ਜਿਹਤੇ ਆਪਾਂ ਪਹੁੰਚ ਜਾਈਏ ਟਾਇਮ ਨਾਲ਼ ਅਤੇ ਮੇਰੀ ਮੀਟਿੰਗ ਵੀ ਕੈਂਸਲ ਨਾ ਹੋਵੇ ਅਤੇ ਤੇਰਾ ਟਾਇਮ ਵੀ ਖਰਾਬ ਨਾ ਹੋਵੇ ਕਿਉਂਕਿ ਉਰੇ ਤਾਂ ਬਹੁਤ ਟਾਇਮ ਲੱਗਣਾ ਧੰਨਵਾਦ